ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ਦੀ ਮੈਂ ਗੱਲ ਕਰਾਂ ਤਾਂ ਖਾਣ ਪੀਣ ਦੀਆਂ ਚੀਜਾਂ ਵਿੱਚ ਜਲੇਬੀ ਬਹੁਤ ਹੀ ਮਸ਼ਹੂਰ ਹੈ ਜੋ ਕੀ ਇਲਾਕੇ ਵਿੱਚ ਹੁੰਦੇ ਛਿੰਝ ਮੇਲਿਆਂ ਦੌਰਾਨ ਬਹੁਤ ਹੀ ਖਾਧੀ ਜਾਂਦੀ ਹੈ ਕਿਉਂਕਿ ਛਿੰਝ ਮੇਲੇ ਜਲੇਬੀਆਂ ਤੋਂ ਬਿਨਾਂ ਫਿੱਕੇ ਜਿਹੇ ਲੱਗਦੇ ਹਨ ਜਲੇਬੀ ਬਣਾਉਣ ਲਈ ਇੱਕ ਖਾਸ ਆਟੇ ਦਾ ਲੇਪ ਬਣਾ ਕੇ ਉਸ ਨੂੰ ਤਲਿਆ ਜਾਂਦਾ ਹੈ ਅਤੇ ਖੰਡ ਦੇ ਘੋਲ ਵਿੱਚ ਪੰਜ ਮਿੰਟ ਲਈ ਰੱਖਿਆ ਜਾਂਦਾ ਹੈ